ਆਪਣਾ ਸ਼ਹਿਰ ਬਠਿੰਡਾ ਹੈ ਅਤੇ ਬਠਿੰਡੇ ਸ਼ਹਿਰ ਦੇ ਵਿੱਚ ਕਿਲ੍ਹਾ ਮੁਬਾਰਕ ਬਹੁਤ ਹੀ ਪ੍ਰਸਿੱਧ ਕਿਲ੍ਹਾ ਹੈ ਇਹ ਕਿਲ੍ਹਾ ਬਹੁਤ ਹੀ ਪੁਰਾਣਾ ਹੈ ਇਸ ਵਿੱਚ ਮੰਨਿਆ ਜਾਂਦਾ ਹੈ ਕਿ ਰਜੀਆ ਸੁਲਤਾਨ ਜੋ ਕਿ ਭਾਰਤ ਦੀ ਕਿਸੇ ਟਾਈਮ ਮਹਾਰਾਣੀ ਸੀ ਉਸ ਨੂੰ ਕੈਦ ਕੀਤਾ ਸੀ ਇਹ ਕਿਲ੍ਹਾ ਬਹੁਤ ਹੀ ਮਜ਼ਬੂਤ ਹੈ ਹੁਣ ਕੁਝ ਕਾਰਨਾਂ ਕਰਕੇ ਇਸ ਕਿਲ੍ਹੇ ਨੂੰ ਢਾਹਿਆ ਵੀ ਗਿਆ ਹੈ ਪਰ ਅਜੇ ਵੀ ਇਹ ਕਿਲ੍ਹਾ ਉਵੇਂ ਦਾ ਉਵੇਂ ਬਰਕਰਾਰ ਹੈ ਇਸ ਕਿਲ੍ਹੇ ਵਿੱਚ ਕੁਝ ਜਿਹੜਾ ਹੈ ਹਨ ਜੋ ਕਿ ਲੋਕਾਂ ਦੇ ਦੇਖਣ ਯੋਗ ਨਹੀਂ ਹਨ ਉਹਨਾਂ ਨੂੰ ਦੇਖਣ ਲਈ ਬੰਦ ਕੀਤਾ ਗਿਆ ਹੈ ਕੁਝ ਕੰਧਾਂ ਕਿਲ੍ਹੇ ਦੀਆਂ ਮਜ਼ਬੂਤ ਨਹੀਂ ਹਨ ਤਾਂ ਉੱਥੇ ਵੀ ਲੋਕਾਂ ਦਾ ਆਉਣਾ ਜਾਣਾ ਬੰਦ ਕੀਤਾ ਗਿਆ ਹੈ ਕਿਲ੍ਹਾ ਸਾਹਿਬ ਦੇ ਵਿੱਚ ਇੱਕ ਗੁਰਦੁਆਰਾ ਹੈ ਗੁਰਦੁਆਰਾ ਉਸ ਵਿੱਚ ਲਗਾਤਾਰ ਚੋਵੀ ਘੰਟੇ ਲੰਗਰ ਚਲਦਾ ਹੈ ਅਤੇ ਲੋਕ ਉਸ ਕਿਲ੍ਹਾ ਸਾਹਿਬ ਵਿੱਚ ਗੁਰਦੁਆਰੇ ਵਿੱਚ ਰੋਜ਼ ਨਤਮਸਤਕ ਹੋਣ ਆਉਂਦੇ ਹਨ ਉਹ ਗੁਰਦੁਆਰਾ ਬਹੁਤ ਹੀ ਇਤਿਹਾਸਕ ਮੰਨਿਆ ਜਾਂਦਾ ਹੈ ਉਸ ਵਿੱਚ ਉਸ ਗੁਰਦੁਆਰੇ ਵਿੱਚ ਅਖੰਡ ਪਾਠ ਕ ਵੀ ਹੁੰਦੇ ਹਨ ਲੋਕਾਂ ਨੂੰ ਇੱਕ ਇੱਕ ਸਾਲ ਪਹਿਲਾਂ ਦੀ ਤਰੀਕ ਲੈਣੀ ਪੈਂਦੀ ਹੈ ਅਖੰਡ ਪਾਠ ਕਰਵਾਉਣ ਲਈ ਇਹ ਕਿਲ੍ਹਾ ਕਿਲ੍ਹਾ ਮੁਬਾਰਕ ਸਾਡੇ ਬਠਿੰਡੇ ਦੀ ਸ਼ਾਨ ਹੈ ਇਸ ਇਹ ਕਿਲ੍ਹਾ ਕਿਲ੍ਹਾ ਮੁਬਾਰਕ ਬਠਿੰਡੇ ਵਿੱਚ ਆਪਾਂ ਕਿਤੇ ਵੀ ਦੂਰੋਂ ਦੇਖ ਸਕਦੇ ਹਾਂ ਇਹ ਬਹੁਤ ਉੱਚੀ ਥਾਂ ਉੱਤੇ ਬਣਿਆ ਹੋਇਆ ਹੈ ਕਿਲ੍ਹਾ ਮੁਬਾਰਕ ਬਠਿੰਡਾ ਦੀ ਹੋਰ ਸ਼ਾਨ ਵਧਾਉਂਦਾ ਹੈ